ਖੇਡਾਂ ਬੰਦੇ ਦੇ ਜੀਵਨ 'ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਜੇ ਖੇਡਾਂ ਨਾ ਹੋਣ ਤਾਂ ਬੰਦੇ ਦਾ ਜੀਵਨ ਵਿਅਰਥ ਹੈ ਬੰਦਾ ਇੱਕ ਇਹੋ ਜਿਹਾ ਬ ਸਰੀਰ ਹੈ ਜਿਸ ਨਾਲ ਖੇਡ ਦੀ ਇਕ ਅਹਿਮ ਭੂਮਿਕਾ ਨਿਭਾਉਂਦੀ ਹਨ ਖੇਡ ਇੱਕ ਬੰਦੇ ਵਿੱਚ ਜਾਨ ਵੀ ਪੁੱਗ ਸਕਦਾ ਹੈ ਖੇਡਾਂ ਬਿਨਾਂ ਆਪਾਂ ਕੋਈ ਵੀ ਕੰਮ ਨਹੀਂ ਕਰ ਸਕਦੇ ਖੇਡ ਹਰ ਇੱਕ ਮਾਸਿਕ ਸਰੀਰ ਵਾਸਤੇ ਨਰੋਈ ਹੈ ਜੇ ਖੇਡ ਨਾ ਹੋਣ ਤਾਂ ਸਮੁਸ਼ੀ ਮਨੁੱਖੀ ਸਰੀਰ ਵਿੱਚ ਨਿਰਾਸ਼ ਰਹਿੰਦਾ ਹੈ ਤ ਤੰਦਰੁਸਤ ਨਹੀਂ ਹੁੰਦਾ ਅਤੇ ਉਸ ਨੂੰ ਆਲਸ ਹਮੇਸ਼ਾ ਹੀ ਰਹਿੰਦਾ ਹੈ ਖੇਡ ਇੱਕ ਇਹੋ ਜਿਹੀ ਚੀਜ਼ ਹੈ ਜੋ ਬੰਦੇ ਦਾ ਸਰੀਰ ਤੰਦਰੁਸਤ ਰੱਖਦੀ ਹਨ ਬੰਦੇ ਦਾ ਮਨੋਬਲ ਬਣਾਉਂਦੀਆਂ ਹਨ ਅਤੇ ਬੰਦੇ ਦਾ ਮਾਨਸਿਕ ਤਨਾਵ ਵੀ ਘਟਾਉਂਦੀਆਂ ਹਨ ਅ ਜਿਹੜੀ ਉਹ ਕਿਹੜੇ ਤਰੀਕੇ ਹਨ ਜਿਹਨਾਂ ਨਾਲ ਖੇਡਾਂ ਨਹੀਂ ਰੁਕ ਸਕਦੀਆਂ ਇਹ ਖੇਡ ਇੱਕ ਇਹੋ ਜਿਹੀ ਚੀਜ਼ ਹੈ ਜੋ ਬੰਦੇ ਦਾ ਇੱਕ ਮਨੋਬਲ ਵੀ ਵਧਾਉਂਦੀਆਂ ਹਨ ਜੇ ਸਰੀਰ ਦੇ ਵਿੱਚ ਵੀ ਤਨਾਅ ਵੀ ਘਟਾਉਂਦੀਆਂ ਹਨ